ਗੇਮਿੰਗ ਅੱਜ ਦਾ ਸਮਾਂ ਟੈਕਨੋਲਜੀ ਦਾ ਦੌਰ ਹੈ ਅਤੇ ਇਸ ਸਮੇਂ ਵਿੱਚ ਕੰਪਿਊਟਰ ਅਤੇ ਮੋਬਾਈਲ ਵਿੱਚ ਕਈ ਤਰ੍ਹਾਂ ਦੀਆਂ ਗੇਮਾਂ ਦੇਖੀਆਂ ਜਾ ਸਕਦੀਆਂ ਹਨ ਜਿਸ ਨੂੰ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਵੱਡੇ ਤੱਕ ਖੇਡਦੇ ਹਨ ਇਹ ਖੇਡਣ ਵਿੱਚ ਕਾਫੀ ਇੰਟਰਸਟਿੰਗ ਹੁੰਦੀਆਂ ਹਨ ਅਤੇ ਇਸ ਇਸ ਨਾਲ ਕਾਫੀ ਆਦਮੀ ਜੇ ਜਾਂ ਇਨਸਾਨ ਕਾਫੀ ਤਰ੍ਹਾਂ ਬਿਜ਼ੀ ਰਹਿੰਦਾ ਹੈ ਅਤੇ ਉਸ ਵਿੱਚ ਉਹਨਾਂ ਨੂੰ ਕਈ ਤਰ੍ਹਾਂ ਦੇ ਟਾਸਕ ਕਰਨੇ ਪੈਂਦੇ ਹਨ ਜਿਸ ਕ ਜਿਸ ਕਾਰਨ ਇਹ ਉਸ ਨੂੰ ਇੰਟਰਸਟਿੰਗ ਲੱਗਦੀਆਂ ਹਨ ਪਰ ਅਸੀਂ ਦੱਸ ਦਈਏ ਕਿ ਬੱਚਿਆਂ ਦੇ ਵਿੱਚ ਇਸ ਦਾ ਪ੍ਰਭਾਵ ਬਹੁਤ ਬੁਰਾ ਪੈਂਦਾ ਹੈ ਅਤੇ ਇਸ ਇਸ ਇਹ ਬੱਚਿਆਂ ਵਿੱਚ ਮਾਨਸਿਕ ਤੌਰ 'ਤੇ ਅਤੇ ਸਰੀਰਕ ਤੌਰ 'ਤੇ ਕਾਫੀ ਪ੍ਰਭਾਵ ਪਾਉਂਦੀਆਂ ਹਨ ਇਸ ਨਾਲ ਸਮੇਂ ਦੀ ਬਰਬਾਦੀ ਹੁੰਦੀ ਹੈ ਅਤੇ ਇਸਦੇ ਵਿੱਚ ਕਈ ਤਰ੍ਹਾਂ ਦੀਆਂ ਗੇਮਾਂ ਅਜਿਹੀਆਂ ਵੀ ਹੁੰਦੀਆਂ ਹਨ ਜਿਸ ਵਿੱਚ ਤੁਸੀਂ ਇੱਕ ਤਰ੍ਹਾਂ ਦਾ ਜੂਆ ਹੁੰਦਾ ਹੈ ਜਿਸ ਨੂੰ ਹਾਰਨ 'ਤੇ ਮਨੁੱਖ ਕਾਫੀ ਪਛਤਾਉਂਦਾ ਹੈ ਇਸ ਤਰ੍ਹਾਂ ਗੇਮਿੰਗ ਦਾ ਭਵਿੱਖ ਵਧੀਆ ਵੀ ਹੈ ਅਤੇ ਇਸ ਦੇ ਕਈ ਨੁਕਸਾਨ ਵੀ ਹਨ